ਪੰਜਾਬ ਦੀ ਕਲਾ ਅਤੇ ਸ਼ਿਲਪਕਾਰੀ ਇੱਥੋਂ ਦੀ ਅਰ ਆਰਥਿਕਤਾ ਵਿੱਚ ਬੜਾ ਵੱਡਾ ਯੋਗਦਾਨ ਪਾਉਂਦੀਆਂ ਇੱਥੋਂ ਦੀ ਹਸਤਕਲਾ ਦੇ ਨਮੂਨੇ ਮੁਟਿਆਰਾਂ ਦੀਆਂ ਕਢਾਈ ਕੀਤੀਆਂ ਹੋਈਆਂ ਜਿਵੇਂ ਫੁਲਕਾਰੀ ਬਾਗ ਆਦਿ ਦੀ ਬਾਹਰ ਬਹੁਤ ਮੰਗ ਹੈ ਇਹਨਾਂ ਚੀਜ਼ਾਂ ਨੂੰ ਨਿਰਯਾਤ ਕਰਕੇ ਪੰਜਾਬ ਦੇਸ਼ ਦੀ ਆਰਥਿਕਤਾ ਵਿੱਚ ਬੜਾ ਯੋਗਦਾਨ ਪਾ ਰਿਹਾ ਹੈ